ਮੈਨੂੰ ਚਿੱਤਰਕਾਰੀ ਕਰਨ ਦਾ ਬਹੁਤ ਜਿਆਦਾ ਸ਼ੌਂਕ ਐ ਇਸ ਲਈ ਮੈਂ ਚਿੱਤਰਕਾਰੀ ਕਰਦੀ ਰਹਿੰਦੀ ਹਾਂ ਤਾਂ ਜੋ ਕੀ ਆਪਣੇ ਜ਼ਿੰਦਗੀ ਦੇ ਵਿੱਚ ਰੰਗਾਂ ਨੂੰ ਹੋਰ ਵੀ ਵਧੀਆ ਨਿਖਾਰ ਕੇ ਲਿਆ ਸਕਾ ਇਸ ਦੇ ਲਈ ਮੈਂ ਵੱਖ ਵੱਖ ਕੰਪਟੀਸ਼ਨਾਂ ਦੇ ਵਿੱਚ ਵੀ ਭਾਗ ਲੈਂਦੀ ਰਹਿਦੀ ਹਾਂ ਇਸੇ ਤਰ੍ਹਾਂ ਇੱਕ ਕਾਲਜ ਸਾਡੇ ਕਾਲਜ ਦੇ ਵਿੱਚ ਚਿੱਤਰਕਾਰੀ ਦਾ ਕੰਪੀਟੀਸ਼ਨ ਕਰਵਾਇਆ ਗਿਆ ਉਸ ਵਿੱਚ ਮੈਂ ਹਿੱਸਾ ਲਿਤਾ ਉਸ ਵਿੱਚ ਸਾਨੂੰ ਇੱਕ ਸਿੰਨਰੀ ਦਿਖਾਈ ਗਈ ਜਿਸ ਵਿੱਚ ਤਿੰਨ ਤੋਂ ਚਾਰ ਘੋੜੇ ਸਨ ਉਹਨਾਂ ਦੀ ਆਕ੍ਰਿਤੀ ਬਣਾਉਣੀ ਸੀ ਉਹ ਦੇਖਣ ਦੇ ਵਿੱਚ ਬਹੁਤ ਹੀ ਗੁੰਝਲਦਾਰ ਲੱਗ ਰਹੀ ਸੀ ਪਹਿਲਾਂ ਤਾਂ ਜਦੋਂ ਮੈਂ ਦੇਖੀ ਤਾਂ ਮੈਨੂੰ ਬਹੁਤ ਡਰ ਲੱਗਿਆ ਕਿਉਂਕਿ ਉਹਨੂੰ ਬਣਾਉਣਾ ਮੈਨੂੰ ਥੋੜਾ ਜਿਹਾ ਔਖਾ ਲੱਗ ਰਿਹਾ ਸੀ ਇਸ ਲਈ ਮੈਂ ਉਹਨੂੰ ਦੇਖਦਿਆ ਸਾਰ ਈ ਥੋੜੀ ਜਿਹੀ ਘਬਰਾ ਗਈ ਪਰ ਜਦੋਂ ਮੈਂ ਉਹਨੂੰ ਸਟਾਰਟ ਕੀਤਾ ਤਾਂ ਜਿਵੇਂ ਜਿਵੇਂ ਸਟੈਪ ਬਾਏ ਸਟੈਪ ਮੈਂ ਉਹਨਾਂ ਨੂੰ ਬਣਾਉਂਦੀ ਗਈ ਤਾਂ ਉਹ ਆਸਾਨੀ ਦੇ ਨਾਲ ਹੀ ਬਣਦੇ ਗਏ ਤਾਂ ਜਦੋਂ ਉਹ ਬਣ ਕੇ ਤਿਆਰ ਹੋ ਗਿਆ ਉਹਦੇ ਵਿੱਚ ਮੈਂ ਰੰਗ ਭਰੇ ਅਤੇ ਰੰਗ ਭਰਨ ਤੋਂ ਬਾਅਦ ਉਹਨਾਂ ਨੂੰ ਜਦੋਂ ਆਊਟਲਾਈਨ ਕੀਤਾ ਤਾਂ ਉਹ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਉਸ ਸਿਨਰੀ ਨੂੰ ਜਦੋਂ ਜਿਸ ਨੇ ਦੇਖਿਆ ਤਾਂ ਉਹਨਾਂ ਨੇ ਵੀ ਮੇਰੀ ਬਹੁਤ ਤਾਰੀਫ ਕੀਤੀ ਮੇਰੇ ਸਕੂ ਕੋਲਜ ਦੇ ਜਿਹੜੇ ਟੀਚਰ ਸੀ ਪ੍ਰਿੰਸੀਪਲ ਸੀ ਉਹਨਾਂ ਨੇ ਵੀ ਬਹੁਤ ਤਾਰੀਫ ਕੀਤੀ ਤਾਂ ਇਸ ਸਿਨਰੀ ਦੇ ਵਿੱਚ ਮੈਨੂੰ ਫਸਟ ਪ੍ਰਾਈਜ ਮਿਲਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਆਪਣੇ ਇੱਕ ਔਖੇ ਡਰੋ ਚਿੱਤਰਕਾਰ ਨੂੰ ਬਣਾਇਆ ਪਾਰ ਕੀਤਾ ਅਤੇ ਫਸਟ ਆਹ ਰੈਂਕ ਹਾਸਿਲ ਕੀਤਾ